ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਰਾਹੁਲ ਦੀ ਮੰ ਮੰਮੀ ਗੱਲ ਕਰ ਰਹੀ ਹਾਂ ਮੈਂ ਨਾ ਪਠਾਨਕੋਟ ਤੋਂ ਥੋੜ੍ਹੀ ਦੂਰ ਚਲੀ ਗਈ ਸੀ ਕਿਤੇ ਗਏ ਸੀ ਆਪਾਂ ਇਸ ਕਰਕੇ ਉਹਦੀ ਫੀਸ ਨਹੀਂ ਮੈਂ ਉਤਾਰ ਸਕੀ ਕੋਈ ਗੱਲ ਨਹੀਂ ਹੁਣ ਮੈਂ ਜਦੋਂ ਪਠਾਨਕੋਟ ਤੋਂ ਹਿਮਾਚਲ ਗਏ ਸੀ ਅਸੀਂ ਇੱਧਰ ਜਦੋਂ ਵਾਪਸ ਆਵਾਂਗੇ ਅਤੇ ਫਿਰ ਅਸੀਂ ਰਾਹੁਲ ਦੇ ਹੱਥ ਜਾਂ ਅ ਔਨਲਾਈਨ ਪੇਅ ਕਰ ਦਵਾਂਗੇ ਕੋਈ ਨਹੀਂ ਜੀ ਮੈਂ ਰਾਹੁਲ ਦੇ ਹੱਥ ਜਾਂ ਮੈਂ ਔਨਲਾਈਨ ਪੇਅ ਕਰ ਦਵਾਂਗੀ ਕੋਈ ਪਰ ਰਾਹੁਲ ਡਾਂਸ ਕਿੱਦਾਂ ਕਿਸ ਤਰ੍ਹਾਂ ਚੱਲ ਰਿਹਾ ਕੰਮ ਉਹਦਾ ਠੀਕ ਚੱਲ ਰਿਹਾ ਵਧੀਆ

ਕੋਈ ਨਹੀਂ ਕੋਈ ਨਹੀਂ ਠੀਕ ਆ ਠੀਕ ਆ ਠੀਕ ਠੀਕ ਆ ਜੀ ਬਸ ਆਹੀ ਆ